ਖੇਡਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਅਤੇ ਇਹ ਬਹੁਤ ਜ਼ਰੂਰੀ ਹੁੰਦੀਆਂ ਹਨ ਮਨੁੱਖ ਵਾਸਤੇ ਖੇਡਾਂ ਦੋ ਪ੍ਰਕਾਰ ਦੀਆਂ ਹਨ ਜਿਵੇਂ ਕਿ ਆਊਟਡੋਰ ਗੇਮਸ ਅਤੇ ਇੰਨਡੋਰ ਗੇਮਸ ਆਊਟਡੋਰ ਗੇਮਸ ਉਹ ਖੇਡਾਂ ਹੁੰਦੀਆਂ ਹਨ ਜਿਹੜੀਆਂ ਕਿ ਚਾਰ ਦੀਵਾਰੀ ਜਾਂ ਘਰ ਤੋਂ ਬਾਹਰ ਜਾ ਕੇ ਖੇਡੀਆਂ ਜਾਣ ਜਿਵੇਂ ਕਿ ਕ੍ਰਿਕਟ ਫੁੱਟਬਾਲ ਵਾਲੀਬਾਲ ਬਾਸਕਿਟਬਾਲ ਆਦਿ ਅਤੇ ਇੰਨਡੋਰ ਗੇਮਸ ਉਹ ਖੇਡਾਂ ਹੁੰਦੀਆਂ ਹਨ ਜਿਹੜੀਆਂ ਕਿ ਚਾਰ ਦੀਵਾਰੀ ਦੇ ਵਿੱਚ ਬੈਠ ਕੇ ਖੇਡੀਆਂ ਜਾਣ ਜਾਂ ਘਰ ਦੇ ਅੰਦਰ ਖੇਡੀਆਂ ਜਾਣ ਜਿਵੇਂ ਕਿ ਕੈਰਮ ਲੂਡੋ ਚੈਸ ਆਦਿ ਖੇਡਾਂ ਦਾ ਖੇਡਾਂ ਆਪਣੇ ਸ ਮਨੁੱਖ ਨੂੰ ਆਪਣੇ ਆਪ ਨੂੰ ਜਾਣਨ ਵਿੱਚ ਬਹੁਤ ਮਦਦ ਕਰਦੀਆਂ ਹਨ ਅਤੇ ਉਹਨੂੰ ਸਟਰੈਸ ਰਿਲੀਜ਼ ਕਰਨ ਵਾਸਤੇ ਬਹੁਤ ਹੈਲਪ ਕਰਦੀਆਂ ਹਨ ਅਤੇ ਲੋਕਾਂ ਨੂੰ ਜਿਵੇਂ ਕਿ ਅੱਜ ਕੱਲ੍ਹ ਬਹੁਤ ਸਾਰਾ ਅ ਮਤਲਬ ਬਹੁਤ ਜਿਵੇਂ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਡਿਪਰੈਸ਼ਨ ਆਦਿ ਦਾ ਆਦਿ ਫੇਸ ਕਰਨਾ ਪੈਂਦਾ ਜ ਫੇਸ ਕਰਦੇ ਹਨ ਅਤੇ ਖੇਡਾਂ ਕਰਕੇ ਉਹ ਉਸ ਚੀਜ਼ ਨੂੰ ਰੋਕ ਸਕਦੇ ਹਨ ਜਿਹਦੇ ਕਰਕੇ ਕਿ ਉਹਨਾਂ ਦੇ ਮੈਂਟਲ ਹੈਲਥ 'ਤੇ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਖੇਡਾਂ ਨਾਲ ਸਾਡੀ ਆਊਟਡੋਰ ਗੇਮਸ ਨਾਲ ਸਾਡੀ ਜਿਹੜੀ ਹੈ ਫਿਜੀਕਲ ਸਟਰੈਂਥ ਵੀ ਵੱਧਦੀ ਹੈ ਸਾਡਾ ਸਟੈਮਿਨਾ ਸਾਡਾ ਕੋਨਫੀਡੈਂਸ ਸਾਡੀਆਂ ਸਕਿੱਲਸ ਅਤੇ ਅਸੀਂ ਸਪੋਰਟਸਮੈਨਸ਼ਿਪ ਵੀ ਸਿੱਖ ਸਕਦੇ ਹਾਂ ਅਤੇ ਆਪਾਂ ਆਪਣੇ ਆਪ ਨੂੰ ਜਾਣਨ ਲਈ ਮਤਲਬ ਆਪਣੇ ਆਪ ਨੂੰ ਹੋਰ ਜਾਣ ਸਕਦੇ ਹਾਂ ਖੇਡਾਂ ਕਰਕੇ ਅਤੇ ਅਸੀਂ ਆਪਣੇ ਦੇਸ਼ ਨੂੰ ਅਪ ਕਿਤੇ ਬਾਹਰ ਮਤਲਬ ਬਾਹਰਲੀਆਂ ਖੇਡਾਂ ਵਿੱਚ ਰਿਪ੍ਰਜੈਂਟ ਕਰ ਸਕਦੇ ਹਾਂ ਅਤੇ ਉਹਨਾਂ ਆਪਣੇ ਦੇਸ਼ ਵਾਸਤੇ ਮੈਡਲ ਲੈ ਕੇ ਆ ਸਕਦੇ ਹਾਂ ਜਿਹਦੇ ਕਰਕੇ ਕਿ ਸਾਡੇ ਘਰਦਿਆਂ ਅਤੇ ਸਾਡੇ ਦੇਸ਼ ਨੂੰ ਸਾਡੇ ਉੱਤੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਜਾਂ ਹੋਊਗਾ